ਗੱਤਕਾ ਮੁੱਖ ਤੌਰ 'ਤੇ ਮਾਰਸ਼ਲ ਆਰਟ ਹੈ ਇਹ ਨਾ ਤਾਂ ਕੋਈ ਖੇਡ ਹੈ ਨਾ ਕੋਈ ਸੱਭਿਆਚਾਰਕ ਅਭਿਆਸ ਹੈ ਸਭਿਆਚਾਰ ਨਾਲ ਇਹਦਾ ਦੂਰ ਦੂਰ ਦਾ ਵੀ ਲੈਣਾ ਦੇਣਾ ਨਹੀਂ ਜਿੱਥੋਂ ਤੱਕ ਗੱਤਕੇ ਦਾ ਸਿੱਖ ਧਰਮ ਦੇ ਨਾਲ ਸੰਬੰਧ ਦੀ ਗੱਲ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਿੱਖ ਧਰਮ ਦਾ ਜਿਹੜਾ ਮੁੱਖ ਮੁੱਦਾ ਹੈ ਸਿੱਖ ਧਰਮ ਦਾ ਜਿਹੜਾ ਮੁੱਖ ਮਕਸਦ ਹੈ ਉਹ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨਾ ਉਹਨਾਂ ਦੀ ਰੱਖਿਆ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਦਸਮ ਪਾਤਸ਼ਾਹ ਨੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਵਰਤੀਆਂ ਜਿਹਦੇ ਵਿੱਚ ਤੇ ਉਹਨਾਂ ਮੁੱਖ ਤੌਰ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਪੰਥ ਦੀ ਸਾਜਨਾ ਕਰਨ ਤੋਂ ਬਾਅਦ ਖਾਲਸਾ ਪੰਥ ਦੇ ਜਿਹੜੇ ਸਿਪਾਹੀ ਆ ਜਿਨ੍ਹਾਂ ਨੂੰ ਸੰਤ ਸਿਪਾਹੀ ਦੇ ਨਾਂ ਨਾਲ ਜਾਣਿਆ ਜਾਂਦਾ ਔਰ ਉਹਨਾਂ ਸਿਪਾਹੀਆਂ ਨੂੰ ਹਥਿਆਰਬੰਦ ਫੌਜਾਂ ਦੇ ਰੂਪ ਦੇ ਵਿੱਚ ਖਾਲਸਾ ਫੌਜ ਦੇ ਰੂਪ ਵਿੱਚ ਤਿਆਰ ਕਰਕੇ ਉਹਨਾਂ ਨੂੰ ਸ਼ਾਸਤਰ ਸ਼ਾਸਤਰ ਕੇ ਅਧੀਨ ਹੈ ਰਾਜ ਦੇ ਮਹਾਂ ਵਾਕ ਅਨੁਸਾਰ ਉਹਨਾਂ ਨੂੰ ਸ਼ਾਸਤਰ ਪਹਿਨਾਇਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਕਿਰਪਾਨ ਪੰਜ ਕਕਾਰ ਸ਼ਾਮਿਲ ਕੀਤੇ ਗਏ ਅਤੇ ਉਹਨਾਂ ਨੂੰ ਇੱਕ ਬਾਣੇ ਦੀ ਬਖਸ਼ਿਸ਼ ਕਰਕੇ ਜਿਹੜੇ ਸਿੰਘ ਯੋਧੇ ਆ ਉਹਨਾਂ ਨੂੰ ਸਾਜਿਆ ਗਿਆ ਪਰ ਇਸ ਚੀਜ਼ ਨੂੰ ਪੂਰਾ ਕਰਨ ਦੇ ਲਈ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਜ਼ੁਰਮ ਦੇ ਟਾਕਰੇ ਨੂੰ ਪੂਰਾ ਕਰਨ ਦੇ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਗੱਤਕਾ ਇੱਕ ਇੱਕ ਮਾਰਸ਼ਲ ਆਰਟ ਜਿਹੜਾ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਹੋਇਆ ਜਿਹਦੇ ਵਿੱਚ ਹਥਿਆਰਾਂ ਨੂੰ ਚਲਾਉਣਾ ਤਲਵਾਰਬਾਜੀ ਘੋੜ ਸਵਾਰੀ ਅਤੇ ਹੋਰ ਵੀ ਜਿੰਨੇ ਵੀ ਆਸ਼ਤਰ ਸ਼ਾਸਤਰ ਹੈ ਉਹਨਾਂ ਨੂੰ ਸਜਾ ਕੇ ਕਿਵੇਂ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਉਤਾਰਨਾ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਕਰਨਾ ਇਹ ਮੁੱਖ ਮਕਸਦ ਜਿਹੜਾ ਗੱਤਕੇ ਦਾ ਸਾਡੇ ਸਾਹਮਣੇ ਨਿਕਲ ਕੇ ਸਾਹਮਣਾ ਆਉਂਦਾ ਉਸ ਸਮੇਂ ਦੇ ਹਿਸਾਬ ਦੇ ਨਾਲ ਹਾਲਾਂਕਿ ਗੱਤਕੇ ਦੀ ਜੇ ਪਰਿਭਾਸ਼ਾ ਅੱਜ ਆਪਾਂ ਅਜੋਕੇ ਸਮੇਂ ਦੇ ਨਾਲ ਦੇਖੀਏ ਤਾਂ ਉਹਦੇ ਵਿੱਚ ਕਈ ਸਾਰੀਆਂ ਤਬਦੀਲੀਆਂ ਜਿਹੜੀਆਂ ਆਈਆਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨਾ ਹੀ ਇੰਨੀ ਟੈਕਨੋਲੋਜੀ ਨਾ ਹੀ ਇੰਨੀ ਗਿਆਨ ਵਿਗਿਆਨ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਸ਼ਾਮਲ ਹੋਇਆ ਸੀ ਉਸ ਟਾਇਮ ਜਿਹੜੀਆਂ ਜੰਗ ਦੇ ਸਮਾਨ ਜੰਗ ਦੇ ਵਿੱਚ ਜਿਹੜਾ ਸਮਾਨ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਵੀ ਆਸਤਰ ਸ਼ਾਸਤਰ ਵਰਤੇ ਜਾਂਦੇ ਸੀ ਉਹ ਹਥਿਆਰਬੰਦ ਹੱਥਾਂ ਦੇ ਨਾਲ ਜਿਹੜੇ ਉਹ ਵਰਤੇ ਜਾਂਦੇ ਸੀ ਸੋ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੱਤਕੇ ਦੀ ਜਿਹੜੀ ਰਸਮ ਹੈ ਗੱਤਕੇ ਦਾ ਜਿਹੜਾ ਅਭਿਆਸ ਉਹਨੂੰ ਸ਼ੁਰੂ ਕਰਵਾਇਆ ਅਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਟਾਕਰੇ ਦੇ ਲਈ ਦੁਸ਼ਮਣ ਦੀਆਂ ਫੌਜਾਂ ਦੇ ਟਾਕਰੇ ਦੇ ਲਈ ਸਿੰਘਾਂ ਨੂੰ ਤਿਆਰ ਬਰ ਤਿਆਰ ਰਹਿ ਕੇ ਉਹਦਾ ਜਿਹੜਾ ਅਭਿਆਸ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲਦਾ ਆਇਆ ਸੋ ਗੱਤਕੇ ਦਾ ਸਿੱਖ ਧਰਮ ਦੇ ਨਾਲ ਜਿਵੇਂ ਨਹੁੰ ਦਾ ਮਾਸ ਦੇ ਨਾਲ ਰਿਸ਼ਤਾ ਇਸ ਧਰਾ ਤਰ੍ਹਾਂ ਗੱਤਕੇ ਦਾ ਸਿੱਖ ਧਰਮ ਦੇ ਨਾਲ ਬਹੁਤ ਡੂੰਘਾ ਜਿਹੜਾ ਸਬੰਧ ਹੈ ਅੱਜ ਵੀ ਆਪਾਂ ਇਹਨੂੰ ਵੱਡੇ ਪੱਧਰ ਦੇ ਉੱਤੇ ਜੇ ਸਕਦੇ ਹਾਂ ਕਿ ਗੱਤਕਾ ਇੱਕ ਸਿੱਖ ਧਰਮ ਦਾ ਇੱਕ ਬਹੁਤ ਵੱਡਾ ਜਿਹੜਾ ਨਮੂਨਾ ਹੈ ਜਾਂ ਕਹਿ ਲਈਏ ਇੱਕ ਸਿੰਬਲ ਹੈ ਇੱਕ ਉਹਦਾ ਪ੍ਰਤੀਕ ਹੈ ਉਹਨੂੰ ਦੇਖਿਆ ਜਾਂਦਾ ਗੱਤਕੇ ਨੂੰ ਸਿੱਖ ਧਰਮ ਦੇ ਤੌਰ ਦੇ ਉੱਤੇ